ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਤੁਸੀਂ ਕੀ ਤੁਹਾਡੀ ਕੀ ਕੁਐਰੀ ਆ ਹਾਂਜੀ ਠੀਕ ਹੈ ਜੀ ਤੁਹਾਨੂੰ ਸਟੇਸ਼ਨਰੀ ਵਧੀਆ ਕੁਆਲਿਟੀ ਦੀ ਮਿਲੂਗੀ ਕੋਈ ਲਾਂਭਾ ਨੀ ਆਏਗਾ ਜੀ ਕੀ ਕੀ ਚਾਹੀਦਾ ਸੀ ਸਟੇਸ਼ਨਰੀ 'ਚ ਠੀਕ ਹੈ ਜਿਹੜਾ ਸਿਲੇਬਸ ਚੱਲ ਰਿਹਾ ਉਸ ਦੇ ਅਕੋਰਡਿੰਗ ਮਿਲੂਗੀ ਕੋਈ ਫਰਕ ਨਹੀਂ ਹੋਏਗਾ ਤੇ ਕੁਆਲਿਟੀ ਵੀ ਵਧੀਆ ਹੋਏਗੀ ਰੇਟ ਵੀ ਤੁਹਾਡੇ ਜਾਇਜ਼ ਹੋਣਗੇ ਤੇ ਟਾਈਮ ਤੇ ਤੁਹਾਨੂੰ ਮਿਲ ਜਾਏਗੀ ਕੋਈ ਕੰਪ ਕਈ ਕੰਪਲੇਟ ਨੀ ਆਏਗੀ ਹਾਂਜੀ ਰੇਟ ਬੁੱਕਸ ਆਰਡਰ ਕੀਤੀਆਂ ਹੋਈਆਂ ਜੋ ਵੀ ਹੋਇਆ ਐਮ ਆਰ ਪੀ ਤੁਹਾਨੂੰ ਲੈਸ ਕਰਕੇ ਵਧੀਆ ਕੁਆਲਿਟੀ ਦੀਆਂ ਬੁਕਸ ਅਸੀਂ ਪ੍ਰੋਵਾਈਡ ਕਰਾਂਗੇ ਹਾਂਜੀ ਹੋਰ ਕੀ ਚਾਹੀਦਾ ਉਹ ਦੱਸੋ ਤੁਸੀਂ ਜੀ ਬੁੱਕਸ ਤੋਂ ਹੀ ਲੈਣਾ ਹੋਰ ਅਸੀਂ ਜਲਦੀ ਤੋਂ ਜਲਦੀ ਭੇਜਣ ਦੀ ਉਹ ਕਰਾਂਗੇ ਤੁਸੀਂ ਸਾਨੂੰ ਲਿਸਟ ਦੇ ਦਿਓ ਵੀ ਆਹ ਚੀਜ਼ ਚਾਹੀਦੀ ਉਹ ਬੈਸਟ ਕੁਆਲਿਟੀ ਦੀ ਮਿਲੇਗੀ ਕੀ ਕੁਛ ਪ੍ਰੋਬਲਮ ਆਉਂਦੀ ਐ ਅਸੀਂ ਮਤਲਬ ਅਵੇਲੇਵਲ ਆ ਹਾਂਜੀ ਹਾਂਜੀ ਅਸੀਂ ਬੈਸਟ ਹੀ ਦਵਾਂਗੇ ਕੁਆਲਿਟੀ ਦੀ ਤੁਹਾਨੂੰ ਪ੍ਰੋਬਲਮ ਹੀ ਨਹੀਂ ਆਏਗੀ ਰਿਟਰਨ ਵੀ ਕੋਈ ਦਿੱਕਤ ਨਹੀਂ ਆਏਗੀ ਐਵੇਂ ਦੀ

ਹਾਂਜੀ ਜੇ ਸੱਤ ਦਿਨਾਂ ਦੇ ਵਿੱਚ ਵਿੱਚ ਤੁਸੀਂ ਰਿਟਰਨ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਜੇ ਕੋਈ ਬ੍ਰੇਕ ਐ ਟੁੱਟੀ ਮਤਲਬ ਫਟੀ ਹੋਈ ਹੈ ਜਾਂ ਜੋ ਵੀ ਆ ਹਾਂਜੀ ਬਾਕੀ ਪੜਨ ਚ ਕੋਈ ਪ੍ਰੋਬਲਮ ਨਹੀਂ ਆਏਗੀ ਜੋ ਵੀ ਉਹਦੇ ਵਿੱਚ ਮਟੀਰੀਅਲ ਹਨ ਪਿਕਸ ਵਗੈਰਾ ਲੱਗੀਆਂ ਹੋਣਗੀਆਂ ਉਹਦੀ ਕੁਆਲਟੀ ਬੈਸਟ ਹੋਏਗੀ ਓਕੇ ਜੀ ਥੈਂਕਯੂ